ਹਾਂਜੀ ਮੈਂ ਆਪਣੀ ਜ਼ਿੰਦਗੀ ਵਿੱਚ ਸ਼ੂਟਿੰਗ ਸਟਾਰ ਦੇਖਿਆ ਹੈ ਅਤੇ ਇਹ ਇੱਕ ਬਹੁਤ ਜ਼ਿਆਦਾ ਸ਼ਾਨਦਾਰ ਅਨੁਭਵ ਹੁੰਦਾ ਹੈ ਇਹ ਕੁਛ ਹੀ ਸੈਕਿੰਡਾਂ ਦਾ ਅਨੁਭਵ ਹੁੰਦਾ ਹੈ ਇਹ ਅਸਮਾਨ 'ਚੋਂ ਧਰਤੀ ਤੱਕ ਲੰਘ ਰਿਹਾ ਹੁੰਦਾ ਹੈ ਅਤੇ ਇਸਨੂੰ ਅਗਰ ਆਪਾਂ ਦੇਖਣਾ ਚਾਹੁੰਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਆਨੰਦਮਇਕ ਮੂਵਮੈਂਟ ਹੁੰਦਾ ਹੈ ਅਸੀਂ ਛੋਟੇ ਹੁੰਦੇ ਛੱਤ 'ਤੇ ਬਹਿ ਜਾਂਦੇ ਸੀਗੇ ਅਤੇ ਅਸਮਾਨ ਵੱਲ ਦੇਖਦੇ ਕੋਈ ਨਾ ਕੋਈ ਸ਼ੂਟਿੰਗ ਸਟਾਰ ਸਾਨੂੰ ਜ਼ਰੂਰ ਦੇਖਣ ਨੂੰ ਮਿਲਦਾ ਸੀਗਾ ਜਦੋਂ ਹੀ ਉਹ ਓ ਸਟਾਰ ਸ਼ੂਟ ਹੁੰਦਾ ਤਾਂ ਅਸੀਂ ਉਸ ਤੋਂ ਕੁਛ ਨਾ ਕੁਛ ਵਿਸ਼ ਮੰਗਦੇ ਸੀਗੇ ਜਿਵੇਂ ਛੋਟੇ ਬੱਚੇ ਮੈਂ ਵੀ ਬਹੁਤ ਵਾਰ ਬਹੁਤ ਕੁਛ ਮੰਗਿਆ ਹੈ ਜਿਵੇਂ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਇਹ ਹੀ ਕਹਿੰਦੇ ਸੀ ਵੀ ਸਾਨੂੰ ਆਹ ਖਿਡੌਣਾ ਮਿਲ ਜਾਵੇ ਆਹ ਮਿਲ ਜਾਵੇ ਇੱਦਾਂ ਹੀ ਅਸੀਂ ਸ਼ੂਟਿੰਗ ਸਟਾਰ ਦੇ ਸ਼ੂਟ ਹੁੰਦਾ ਹੀ ਇੰਤਜ਼ਾਰ ਕਰਦੇ ਸੀ ਕਦੋਂ ਹੋਵੇਗਾ ਤੇ ਅਤੇ ਕਦੋਂ ਕੁਛ ਮੰਗਾਂਗੇ ਤਾਂ ਅਸੀਂ ਹੁਣ ਵੀ ਅੱਜ ਉਸ ਚੀਜ਼ਾਂ ਨੂੰ ਮਿਸ ਕਰਦੇ ਹਾਂ ਕਈ ਵਾਰ ਜਦੋਂ ਟੁੱਟਿਆ ਹੋਇਆ ਮਤਲਬ ਟੁੱਟਿਆ ਹੋਇਆ ਤਾਰਾ ਜਾਂ ਸ਼ੂਟ ਸਟਾਰ ਦੇਖਦੇ ਹਾਂ ਤਾਂ ਅੱਜ ਵੀ ਅਸੀਂ ਵਿਸ਼ ਮੰਗਦੇ ਹਾਂ